ਸਰਕਾਰ ਦੁਆਰਾ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਕਾਰਗੁਜ਼ਾਰੀ ਕਾਰਜਸ਼ਾਲਾਵਾਂ ਚਲਾਈਆਂ ਜਾ ਰਹੀਆਂ ਹਨ ਇਸ ਦੇ ਵਿੱਚ ਨੌਜਵਾਨਾਂ ਨੂੰ ਖੇਡਾਂ ਦੇ ਵਿੱਚ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ ਖੇਡਾਂ ਦੇ ਵਿੱਚ ਭਾਗ ਲੈਣ ਦੇ ਨਾਲ ਉਹਨਾਂ ਨੂੰ ਸਰਟੀਫਿਕੇਟ ਵਗੈਰਾ ਮਿਲਦੇ ਹਨ ਜਿਨਾਂ ਨੂੰ ਨੌਜਵਾਨਾਂ ਲਈ ਬਹੁਤ ਲਾਭਕਾਰੀ ਹੁੰਦਾ ਹੈ ਜੋ ਕਿ ਉਹਨਾਂ ਦੇ ਅੱਗੇ ਫਿਊਚਰ ਦੇ ਵਿੱਚ ਉਹਨਾਂ ਨੂੰ ਬਹੁਤ ਆਸਾਨੀ ਨਾਲ ਸਰਕਾਰੀ ਜੋਬ ਵਿੱਚ ਬਹੁਤ ਫਾਇਦੇਮੰਦ ਰਹਿੰਦਾ ਹੈ ਕਾਰਗੁਜ਼ਾਰੀ ਕਾਰਜਸ਼ਲਾਵਾਂ ਚਲਾਈਆਂ ਜਾਣ ਦੇ ਨਾਲ ਨੌਜਵਾਨਾਂ ਦੇ ਭਵਿੱਖ ਬਹੁਤ ਹੀ ਉਜਾਗਰ ਦਿਖ ਰਹੇ ਸਨ